ਯੋਗ ਅਭਿਆਸ ਕਰਨਾ ਬਹੁਤ ਹੀ ਵਧੀਆ ਗੱਲ ਹੁੰਦੀ ਹੈ ਯੋਗ ਅਭਿਆਸ ਨਾਲ ਸਾਡਾ ਸਰੀਰ ਪ੍ਰਫੁੱਲਤ ਰਹਿੰਦਾ ਹੈ ਇਸਨੂੰ ਅਗਰ ਅਸੀਂ ਸਵੇਰੇ ਸਵੇਰੇ ਖਾਲੀ ਪੇਟ ਕਰੀਏ ਤਾਂ ਬਹੁਤ ਹੀ ਵਧੀਆ ਸਾਨੂੰ ਇਸ ਦੇ ਲਾਭ ਮਿਲਦੇ ਹਨ ਜਿਵੇਂ ਕਿ ਸਾਡਾ ਸਾਰਾ ਦਿਨ ਬਹੁਤ ਹੀ ਵਧੀਆ ਖੁਸ਼ ਮਿਜ਼ਾਜ ਨਾਲ ਨਿਕਲਦਾ ਹੈ ਸਾਡੇ ਸਰੀਰ ਵਿੱਚ ਚੁਸਤੀ ਅਤੇ ਫੁਰਤੀ ਸਾਰਾ ਦਿਨ ਭਰੀ ਰਹਿੰਦੀ ਹੈ ਅਸੀਂ ਜਿੰਨਾ ਮਰਜ਼ੀ ਕੰਮ ਕਰ ਕਰੀਏ ਸਾਨੂੰ ਬਿਲਕੁਲ ਵੀ ਥਕਾਵਟ ਨਹੀਂ ਹੁੰਦੀ ਅਸੀਂ ਯੋਗ ਕਰਨ ਦੇ ਨਾਲ ਨਾਲ ਆਪਣਾ ਬਹੁਤ ਸਾਰਾ ਵਜ਼ਨ ਵੀ ਘਟਾ ਸਕਦੇ ਹਾਂ ਅਤੇ ਸਾਨੂੰ ਇਸ ਨਾਲ ਬਹੁਤ ਹੀ ਲਾਭ ਹੁੰਦੇ ਹਨ ਯੋਗ ਸਾਡੀ ਸਰੀਰ ਦੀ ਬਣਾਵਟ ਸਾਡੇ ਸਰੀਰ ਦੀ ਥਕਾਵਟ ਨੂੰ ਦੂਰ ਕਰਦਾ ਹੈ ਬਣਾਵਟ ਬਹੁਤ ਵਧੀਆ ਬਣਾਉਂਦਾ ਹੈ ਔਰ ਸਾਡੀਆਂ